ਮੈਂ ਵਿਜੇ ਗੁਰਦਾਸਪੁਰ ਜ਼ਿਲ੍ਹੇ ਦਾ ਵਾਸੀ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਸਾਡੇ ਭਾਰਤ ਦੇਸ਼ ਵਿੱਚ ਵੀ ਅਜਿਹੀ ਪ੍ਰਣਾਲੀ ਦਾ ਪੁਨਰਵਾਸ ਹੋ ਰਿਹਾ ਹੈ ਕਿ ਜੋ ਕਿ ਬਾਹਰਲੇ ਦੇਸ਼ਾਂ ਵਿੱਚ ਹੁੰਦਾ ਹੈ ਜਿਵੇਂ ਕਿ ਘਰਾਂ ਵਿੱਚ ਗੈਸ ਸਪਲਾਈ ਦਾ ਕੇਂਦਰੀਕ੍ਰਿਤ ਤਰੀਕੇ ਨਾਲ ਕੰਮ ਕਰਨਾ ਇਸ ਲਈ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਸਾਡੇ ਦੇਸ਼ ਲਈ ਇਹ ਇੱਕ ਬੜੀ ਵਧੀਆ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਹੁਣ ਸਾਨੂੰ ਥਾਂ ਥਾਂ 'ਤੇ ਸਿਲੰਡਰ ਗੈਸ ਸਿਲੰਡਰਾਂ ਵਿੱਚ ਗੈਸ ਸਿਲਿੰਡਰਾਂ ਦੀ ਬੁਕਿੰਗ ਲਈ ਜਾਂ ਗੈਸ ਸਿਲੰਡਰ ਲੈਣ ਲਈ ਆਪਣੀ ਏਜੰਸੀ ਵਿੱਚ ਵਾਰ ਵਾਰ ਨਹੀਂ ਜਾਣਾ ਪਵੇਗਾ ਇਸ ਲਈ ਅਸੀਂ ਇਹ ਆਪਣੀ ਗੈਸ ਏਜੰਸੀ ਨੂੰ ਇਹ ਗੱਲ ਦੱਸਦੇ ਹਾਂ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਵੱਲੋਂ ਕੀਤੇ ਗਏ ਤੁਹਾਡੇ ਵੱਲੋਂ ਕੀਤੇ ਗਏ ਗੈਸ ਸਿਲੰਡਰ ਦੀ ਜੋ ਬੁਕਿੰਗ ਕੀਤੀ ਜਾਂਦੀ ਸੀ ਉਹਦੀ ਹੁਣ ਸਾਨੂੰ ਜ਼ਰੂਰਤ ਨਹੀਂ ਹੈ ਕਿਉਂਕਿ ਹੁਣ ਸਾਡੇ ਘਰਾਂ ਵਿੱਚ ਗੈਸ ਸਪਲਾਈ ਦਾ ਸਰਕਾਰ ਵੱਲੋਂ ਕੇਂਦਰੀਕ੍ਰਿਤ ਗੈਸ ਤਰੀਕੇ ਨਾਲ ਪਾਈਪਾਂ ਦੀ ਵਿਸ਼ਾਈ ਕੀਤੀ ਗਈ ਹੈ ਜੋ ਕਿ ਸਮੇਂ ਸਮੇਂ 'ਤੇ ਜਿੰਨੀ ਗੈਸ ਲਵੇਗੀ ਮਿਲੇਗੀ ਉਨਾ ਹੀ ਅਸੀਂ ਉਸ ਬਿੱਲ ਦਾ ਭੁਗਤਾਨ ਕਰਾਂਗੇ ਇਸ ਲਈ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਹੁਣ ਗੈਸ ਸਿਲੰਡਰ ਦੀ ਬੁਕਿੰਗ ਦਾ ਕੰਮ ਬੰਦ ਕੀਤਾ ਜਾਵੇ ਤਾਂ ਜੇ ਸਮਾਂ ਮਿਲਿਆ ਤਾਂ ਅਸੀਂ ਸਿਲਿੰਡਰ ਦੀ ਬੁਕਿੰਗ ਐਮਰਜੈਂਸੀ ਕਰਵਾਵਾਂਗੇ ਨਹੀਂ ਤਾਂ ਸਾਨੂੰ ਇਹਨਾਂ ਦੀ ਇਸ ਕੰਮ ਲਈ ਦੀ ਬੜੀ ਹੀ ਵਧੀਆ ਤਰੀਕੇ ਨਾਲ ਪੇਸ਼ਕਾਰੀ ਮਿਲੀ ਹੈ ਧੰਨਵਾਦ